ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਜੀ ਹਾਂਜੀ ਹਾਂਜੀ ਇਸ ਟਾਈਮ ਸੈਮਸੰਗ ਦੇ ਰੈਡਮੀ ਦੇ ਸੋਆਮੀ ਦੇ ਅਤੇ ਮੋਟੋ ਦੇ ਆਈਫੋਨ ਇਹ ਲੇਟੈਸਟ ਚੱਲ ਰਹੇ ਨੇ ਤੁਸੀਂ ਦੱਸੋ ਤੁਹਾਡੀ ਕੀ ਰੇਂਜ ਹੈ ਤੁਸੀਂ ਕਿਸ ਆਪਣੇ ਅਫੋਡੇਬਲ ਰੇਂਜ ਦੇ ਹਿਸਾਬ ਨਾਲ ਚੱਲਣਾ ਚਾਹੋਗੇ ਹਾਂਜੀ ਠੀਕ ਹੈ ਨੀਅਰ ਅਬਾਊਟ ਤੁਸੀਂ ਮਤਲਬ ਪੰਦਰਾਂ ਹਜ਼ਾਰ ਦੇ ਅਰਾਊਂਡ ਜਾਂ ਫਿਫਟੀ ਪਲੱਸ ਅਤੇ ਜਾਂ ਫਿਰ ਟਵੰਟੀ ਫਾਈਵ ਠੀਕ ਹੈ ਤੁਹਾਨੂੰ ਮੈਂ ਦੱਸ ਦਿੰਦੀ ਹਾਂ ਕਿ ਰੈਡਮੀ ਦੇ ਨੋਟ ਟਵੈਲਵ ਜਿਹੜਾ ਆ ਉਹਦੀ ਇਸ ਟਾਈਮ ਅਮਾਊਂਟ ਟੈਂਨ ਥਾਊਜੈਂਟ ਦੇ ਅਰਾਉਂਡ ਟਵੈਲ ਥਾਊਜੈਂਟ ਦੇ ਅਰਾਊਂਡ ਵੰਨ ਟਵੈਂਟੀ ਏਟ ਜੀ ਬੀ ਉਹਦੀ ਰੈਮ ਹੋਏਗੀ ਸਿਕਸ ਜੀ ਬੀ ਉਹਦੀ ਇੰਟਰਨਲ ਹੋਏਗੀ ਅਤੇ ਫਾਈਵ ਫਾਈਵ ਡ ਟ੍ਰਿਪਲ ਜ਼ੀਰੋ ਜਿਹੜੀ ਉਹਦੀ ਐੱਮ ਐੱਚ ਹੋਏਗੀ ਬੈਟਰੀ ਬੈਕਅਪ ਕੁਆਲਿਟੀ ਵਾਈਜ਼ ਅੱਛੇ ਨੇ ਕੈਮਰਾ ਕੁਆਲਿਟੀ ਜੇ ਤੁਸੀਂ ਚਾਹੁੰਦੇ ਹੋ ਬੈਸਟ ਟੂ ਬੈਸਟ ਫਿਰ ਆਈਫੋਨ ਦੀ ਹੈ ਅਤੇ ਆਈਫੋਨ ਦੀ ਰੇਂਜ ਹੈ ਹਾਂਜੀ ਅੱਛਾ ਅੱਛਾ ਜੀ ਹਾਂਜੀ ਠੀਕ ਹੈ ਉਹਦੇ ਲਈ ਫਿਰ ਤੁਸੀਂ ਜੇ ਤੁਸੀਂ ਐੱਮ ਆਈ ਦੀ ਵੀ ਕੁਆਲਿਟੀ ਵੈਸੇ ਅੱਛੀ ਹੈ ਕੈਮਰਾ ਕਲੈਰਿਟੀ ਅੱਛੀ ਜੇ ਤੁਸੀਂ ਘੱਟ ਰੇਂਜ 'ਚ ਲੈਣਾ ਚਾਹੁੰਦੇ ਹੋ ਐੱਮ ਆਈ ਦੀ ਵੀ ਅੱਛੀ ਕੁਆਲਿਟੀ ਹੈ ਬਟ ਅਗਰ ਤੁਸੀਂ ਬੈਸਟ ਚੀਜ਼ ਚਾਹੁੰਦੇ ਹੋ ਅਤੇ ਫਿਰ ਤੁਹਾਨੂੰ ਆਈਫੋਨ ਹੀ ਲੈਣਾ ਪਏਗਾ ਉਹਦੀ ਫਿਫਟੀ ਪਲੱਸ ਸੈਵਨਟੀ ਫਾਈਵ ਪਲੱਸ ਰੇਂਜ ਆਏਗੀ ਅਤੇ ਉਹਦਾ ਹਾਂਜੀ ਹਾਂਜੀ ਸਕਿਉਰਟੀ ਬੈਕਅਪ ਹਰ ਚੀਜ਼ ਉਹਦੀ ਬੈਸਟ ਹੈ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਠੀਕ ਹੈ ਠੀਕ ਹੈ ਜੀ ਵੈਸੇ ਬੈਸਟ ਜੇ ਤੁਹਾਨੂੰ ਕੈਮਰਾ ਕਲੈਰਿਟੀ ਚਾਹੀਦੀ ਹੈ ਅਤੇ ਉਹ ਤੁਹਾਡੇ ਲਈ ਐਪਲ ਬੈਸਟ ਰਹੇਗਾ ਹਾਂਜੀ ਹਾਂਜੀ ਰਾਤ ਨੌ ਵਜੇ ਤੱਕ ਖੁੱਲੀ ਹੈ ਜਦੋਂ ਮਰਜੀ ਆ ਸਕਦੇ ਹੋ ਹਾਂਜੀ ਨਹੀਂ ਨਹੀਂ ਨਹੀਂ ਨਹੀਂ ਸੰਡੇ ਔਫ ਹੁੰਦਾ ਬਸ ਹਾਂਜੀ ਠੀਕ ਆ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹ ਹਰ ਕੁਆਲਿਟੀ ਦੇ ਜਿਸ ਤਰ੍ਹਾਂ ਦੇ ਕਹੋਗੇ ਉਸ ਤਰ੍ਹਾਂ ਦੇ ਮਿਲ ਜਾਣਗੇ ਠੀਕ ਹੈ ਠੀਕ ਹੈ ਜੀ ਓਕੇ ਓਕੇ ਵੈਲਕਮ ਜੀ